ਹੈਲੋ ਹਾਂਜੀ ਕੌਣ ਬੋਲਦਾ ਜੀ

ਹਾਂ ਬੋਲੋ ਬੋਲੋ ਹਾਂਜੀ

ਕੋਈ ਗੱਲ ਨਹੀਂ ਅਸੀਂ ਦੁਬਾਰਾ ਉਹ ਜੀ ਅਸੀਂ ਜੇ ਪਤਾ ਕਰਕੇ ਚੰਗੀ ਤਰ੍ਹਾਂ ਤੁਹਾਡੇ ਵਰਕਰਾਂ ਨੂੰ ਅਸੀਂ ਕਹਿ ਦਿਆਂਗੇ ਕਿ ਤੁਸੀਂ ਅਸੀਂ ਫਿਰ ਦੁਬਾਰਾ ਚੈੱਕ ਕਰ ਲਵਾਂਗੇ ਪੈਸੇ ਤਾਂ ਜੀ ਠੀਕ ਆ ਉਹ ਤਾਂ ਜਿਹੜਾ ਰੇਟ ਆ ਤੁਸੀਂ ਉਹ ਹੀ ਦੇਣਾ ਹੈ ਹੋਰ ਵੱਧ ਕੇ ਤਾਂ ਅਸੀਂ ਲੈਂਦੇ ਨਹੀਂ ਗੇ ਉਹ ਕਈ ਵਾਰ ਹੋ ਜਾਂਦਾ ਸਿਲਿੰਡਰਾਂ ਦੇ ਵਿੱਚ ਇੱਧਰ ਉੱਧਰ ਕੋਈ ਅਸੀਂ ਤਾਂ ਕੋਈ ਇਹੋ ਜਿਹਾ ਕਰਦੇ ਨਹੀਂ ਕੰਮ ਗੈਸ ਏਜੰਸੀ 'ਚ ਤਾਂ ਤੁਸੀਂ ਜਾਣੀ ਅ ਉਹ ਚੰਗੀ ਤਰ੍ਹਾਂ ਆ ਕੇ ਵੈਸੇ ਚਾਹੇ ਤਸੱਲੀ ਕਰ ਲਿਉ ਬਾਕੀ ਗੱਡੀ ਲੈ ਕੇ ਆਉਂਦੇ ਆ ਉਹਨਾਂ ਨੂੰ ਅਸੀਂ ਵਰਕਰਾਂ ਨੂੰ ਕਹਿ ਦਿਆਂਗੇ ਵੀ ਤੁਸੀਂ ਚੰਗੀ ਤਰ੍ਹਾਂ ਸਿਲੰਡਰ ਗੈਸ ਕਸਟਮਰ ਨੂੰ ਪਹੁੰਚਾਓ ਨਹੀਂ ਨਹੀਂ ਇਹ ਤਾਂ ਰਾਜੇ ਹੋ ਹੀ ਨਹੀਂ ਸਕਦਾ ਵੀ ਅਸੀਂ ਇਸ ਤਰ੍ਹਾਂ ਘੱਟ ਦੇਈਏ ਪਿੱਛੇ ਤੋਂ ਭਰੇ ਹੀ ਸਿਲਿੰਡਰ ਇਸ ਤਰ੍ਹਾਂ ਆਉਂਦੇ ਇੱਥੇ ਨਹੀਂ ਕੋਈ ਇਹੋ ਜਿਹਾ ਕੋਈ ਗੜਬੜ ਵਾਲੀ ਗੱਲ ਹਾਂਜੀ ਹਾਂਜੀ ਜੀ ਚੌਦ੍ਹਾਂ ਪੰਦਰ੍ਹਾਂ ਕਿਲੋ ਗੈਸ ਹੁੰਦੀ ਹੈ ਵਿੱਚ ਤੁਸੀਂ ਚੈੱਕ ਕਰੋ ਤੁਹਾਡੇ ਚਲਾਉਣ 'ਚ ਕੋਈ ਖ਼ਰਾਬੀ ਹੋ ਗਈ ਹੋਣੀ ਹੈ ਉਹ ਅਸੀਂ ਕਹਿ ਨਹੀਂ ਸਕਦੇ ਪਰ ਸਾਡੀ ਗੈਸ ਦਾ ਇਹੋ ਜਿਹਾ ਕੋਈ ਨਹੀਂ ਨਹੀਂ ਫਿਰ ਤੁਹਾਡੇ ਕੋਈ ਰੈਗੂਲੇਟਰ 'ਚ ਕੋਈ ਖ਼ਰਾਬੀ ਹੋਊਗੀ ਹੈਂ ਨ ਨਹੀਂ ਨਹੀਂ ਨਹੀਂ ਨਹੀਂ ਤੁਸੀਂ ਦੁਬਾਰਾ ਕਿਸੇ ਤੋਂ ਚੈੱਕ ਕਰਵਾਓ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਅਸੀਂ ਖੁਦ ਦੂਜਿਆਂ ਦੀ ਤੁਸੀਂ ਤੁਸੀਂ ਜਾਇਓ ਆਪਣਾ ਰੈਗੁਲੇਟਰ ਬਦਲਾਉਣਾ ਹੋਇਆ ਤਾਂ ਬਦਲਾ ਲਓ ਸਾਡੀ ਏਜੰਸੀ 'ਚੋਂ ਵੀ ਮਿਲ ਸਕਦੀ ਜੀ ਠੀਕ ਹੈ ਠੀਕ ਹ ਨਹੀਂ ਨਹੀਂ ਕੋਈ ਗੱਲ ਨਹੀਂ ਐਂ ਤਾਂ ਸਾਰੀ ਦੁਨੀਆਂ ਲੈਂਦੀ ਆ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਆਇਓ ਜ਼ਰੂਰ ਅਤੇ ਜਾਨੀ ਅਸੀਂ ਚੈੱਕ ਕਰ ਲਵਾਂਗੇ ਬੇਸ਼ੱਕ ਦੀ ਸਲੈਂਡਰ ਜੇ ਨਹੀਂ ਵੀ ਤੁਸੀਂ ਚਲਾਇਆ ਨਾ ਤਾਂ ਫਿਰ ਅਸੀਂ ਤੁਹਾਨੂੰ ਦੁਬਾਰਾ ਬਦਲ ਕੇ ਦੇ ਦੇਵਾਂਗੇ ਠੀਕ ਆ ਆਉਣ ਦੀ ਜ਼ਰੂਰ ਕੋਸ਼ਿਸ਼ ਕਰਨੀ ਹਾਂ ਹੋਰ ਕੋਈ ਵੱਧ ਘੱਟ ਬਿੱਲ ਤੁਹਾਨੂੰ ਬਿੱਲ ਵੀ ਕੱਟ ਕੇ ਦੇਵਾਂਗੇ ਸਾਰਾ ਕੁਛ ਕਰਕੇ ਦੇਵਾਂਗੇ ਤੁਹਾਡਾ ਕਿਹੜੀ ਕ ਤੁਹਡਾ ਤੁਹਾਡਾ ਕਿਹੜੀ ਏਜੰਸੀ ਦਾ ਹੈਗਾ ਭਾਰਤ ਗੈਸ ਆ ਕ ਕਿਹੜਾ ਪਨਸਪ ਹੈ ਠੀਕ ਹੈ ਜੀ ਭਾਰਤ ਗੈਸ ਵਾਲਿਆਂ ਦਾ ਸਲੰਡਰ ਹੈ ਠੀਕ ਹੈ ਨਹੀਂ ਨਹੀਂ ਤੁਸੀਂ ਆਇਓ ਠੀਕ ਹੈ ਹਾਂ ਹਾਂਜੀ ਅੱਗੇ ਨਹੀਂ ਨਹੀਂ ਅੱਗੇ ਤਾਂ ਤੁਸੀਂ ਚੈੱਕ ਕਰਕੇ ਨਾ ਤੁਹਾਨੂੰ ਤੁਸੀਂ ਆਪਣਾ ਰੈਗੂਲੇਟਰ ਟੈਸਟ ਕਰਵਾਓ ਚੰਗੀ ਤਰ੍ਹਾਂ ਉਹਦੇ ਕਰਕੇ ਕੋਈ ਕਈ ਵਾਰ ਖ਼ਰਾਬੀ ਹੋ ਜਾਂਦੀ ਹੈ ਪਰ ਸਾਡੀ ਏਜੰਸੀ ਇਹੋ ਜਿਹੀ ਕਦੇ ਵੀ ਗਲਤੀ ਨਹੀਂ ਹੋਊ ਜੇ ਤੁਹਾਨੂੰ ਨਹੀਂ ਵੀ ਯਕੀਨ ਤੁਸੀਂ ਸਲਿੰਡਰ ਵਾਪਸ ਕਰਕੇ ਲਿਆ ਕੇ ਸਾਡੇ ਕੋਲ ਪਹੁੰਚਾ ਸਕਦੇ ਠੀਕ ਆ ਓਕੇ